ਪੰਜਾਬ ਵਿੱਚ ਬਹੁਤ ਸਾਰੀਆਂ ਪਰੰਪਰਾਵਾਂ ਅਤੇ ਰੀਤ ਰੀਤੀ ਰਿਵਾਜ਼ ਪ੍ਰਚੱਲਿਤ ਹਨ ਜਿਨ੍ਹਾਂ ਵਿੱਚ ਕਿ ਪਿਛਲੇ ਪਿਛੋਕੜ ਤੋਂ ਜਿਹੜੇ ਚੱਲਦੇ ਆ ਰਹੇ ਹਨ ਜਿਵੇਂ ਕਿ ਸਿਰ 'ਤੇ ਮੱਥਾ ਟੇਕਣਾ ਮਾੜੀ 'ਤੇ ਮੱਥਾ ਟੇਕਣਾ ਖਵਾਜੇ ਦਾ ਮੱਥਾ ਟੇਕਣਾ ਖੇੜੇ 'ਤੇ ਮੱਥਾ ਟੇਕਣਾ ਇਹ ਰੀਤ ਪਰੰਪਰਾਵਾਂ ਰੀਤੀ ਰਿਵਾਜ਼ ਇਹ ਪਿੱਛੇ ਤੋਂ ਚੱਲਦੇ ਆ ਰਹੇ ਹਨ ਜੋ ਕਿ ਲੋਕ ਅੱਜ ਵੀ ਅਪਣਾਉਂਦੇ ਹਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰੀਤੀ ਰਿਵਾਜ਼ 'ਤੇ ਪਰੰਪਰਾਵਾਂ ਹਨ ਜਿਵੇਂ ਕਿ ਵਿਆਹ ਵੇਲੇ ਵੀ ਬਹੁਤ ਸਾਰੇ ਹੁੰਦੇ ਹਨ ਜਿਵੇਂ ਕਿ ਵਿਆਹ ਵਾਲੇ ਵਰ ਨੂੰ ਮੱਥਾ ਟਿਕਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ 'ਚ ਉਸ ਤੋਂ ਬਾਅਦ ਜੰਨ ਚੜਾਈ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਵਿਆਹ ਕੇ ਆਉਂਦੇ ਹਨ ਉਸ ਤੋਂ ਬਾਅਦ ਵੀ ਮੱਥਾ ਪਾਣੀ ਵਾਰਿਆ ਜਾਂਦਾ ਹੈ ਇਹ ਵੀ ਇੱਕ ਰੀਤੀ ਰਿਵਾਜ਼ ਹੈ ਅਤੇ ਦੂਜੇ ਦਿਨ ਦੋਵਾਂ ਵਰ ਅਤੇ ਵਧੂ ਨੂੰ ਮੱਥਾ ਟਿਕਾਇਆ ਜਾਂਦਾ ਹੈ ਇਸ ਤਰ੍ਹਾਂ ਪੰਜਾਬ ਵਿੱਚ ਬਹੁਤ ਸਾਰੇ ਰੀਤੀ ਰਿਵਾਜ਼ ਪ੍ਰਚੱਲਿਤ ਹਨ ਜਿਹਨਾਂ ਵਿੱਚ ਕਿ ਮੱਥੇ ਟੇਕੇ ਜਾਂਦੇ ਹਨ ਧਾਰਮਿਕ ਅਸਥਾਨਾਂ 'ਤੇ ਅਤੇ ਹੋਰ ਵੀ ਜਿਹੜੇ ਵਿਆਹਾਂ ਵੇਲੇ ਕੀਤੇ ਜਾਂਦੇ ਹਨ ਜਾਂ ਫਿਰ ਕਿਸੇ ਬੱਚੇ ਦੇ ਜਨਮ ਵੇਲੇ ਕੀਤੇ ਜਾਂਦੇ ਹਨ ਬਹੁਤ ਸਾਰੇ ਰੀਤੀ ਰਿਵਾਜ਼ ਪ੍ਰਚੱਲਿਤ ਹਨ